ਮੇਰੇ ਕੋਲ ਸਿਲਾਈ ਬੁਣਾਈ ਅਤੇ ਕਢਾਈ ਦਾ ਇੱਕ ਬਹੁਤ ਵਧੀਆ ਹੁਨਰ ਹੈ ਮੈਂ ਇਹ ਆਪਣਾ ਹੁਨਰ ਸਭ ਤੋਂ ਪਹਿਲਾਂ ਆਪਣੇ ਸਕੂਲ ਦੇ ਅਧਿਆਪਕ ਅਤੇ ਉਸ ਤੋਂ ਬਾਅਦ ਆਪਣੀ ਮਾਂ ਕੋਲੋਂ ਸਿੱਖਿਆ ਕਿਉਂਕਿ ਮੇਰੀ ਮਾਂ ਨੂੰ ਕਢਾਈ ਸਿਲਾਈ ਦਾ ਬਹੁਤ ਹੁਨਰ ਸੀ ਅਤੇ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਈ ਹੌਲੀ ਹੌਲੀ ਕਰਕੇ ਉਹਨਾਂ ਨੇ ਮੈਨੂੰ ਜਿਸ ਕੰਮ ਤੋਂ ਕਮੀ ਲੱਗਦੀ ਸੀ ਉਹ ਮੈਨੂੰ ਚੰਗੀ ਤਰ੍ਹਾਂ ਸਿਖਾਉਂਦੇ ਸਨ ਅਤੇ ਫਿਰ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਕਰੋਸ਼ੀਏ ਤੋਂ ਫਿਰ ਸਿਲਾਈਆਂ ਸਟਿਚਿੰਗ ਸਿਲਾਈ ਅਤੇ ਫਿਰ ਉਸ ਤੋਂ ਬਾਅਦ ਸਟਲ ਵੀ ਚਲਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਮੈਨੂੰ ਆਉਂਦਾ ਗਿਆ ਤਾਂ ਫਿਰ ਮੇਰੀ ਮਾਂ ਨੇ ਮੈਨੂੰ ਉਸ ਵਿੱਚ ਕਮੀਆਂ ਕੱਢ ਕੇ ਦੂਰ ਕੀਤੀਆਂ ਅਤੇ ਮੈਂ ਉਸ ਨੂੰ ਚੰਗੀ ਤਰ੍ਹਾਂ ਚਲਾਉਣਾ ਸ਼ੁਰੂ ਕਰ ਦਿੱਤਾ ਫਿਰ ਜਿਉਂ ਜਿਉਂ ਸਮਾਂ ਬਦਲਿਆ ਤਾਂ ਫਿਰ ਉਸਨੂੰ ਮੈਂ ਯੂਟੀਊਬ ਚੈਨਲ ਤੋਂ ਵੀ ਨਵੇਂ ਨਵੇਂ ਡਿਜ਼ਾਈਨ ਦੇਖਣੇ ਸ਼ੁਰੂ ਕੀਤੇ ਅਤੇ ਉਹਨਾਂ ਤੋਂ ਵੀ ਮੈਂ ਬਹੁਤ ਕੁਛ ਸਿੱਖਿਆ ਜਿਸ ਕਾਰਨ ਮੈਨੂੰ ਬਹੁਤ ਫਾਇਦਾ ਹੋਇਆ ਅਤੇ ਮੈਂ ਫਿਰ ਸਮੇਂ ਦੇ ਬਾਅਦ ਕੁਛ ਸਮੇਂ ਤੋਂ ਬਾਅਦ ਮੈਂ ਮੈਗਜੀਨਾਂ ਤੋਂ ਅਤੇ ਮਨੋਰਮਾ ਗ੍ਰਹਿ ਸ਼ੋਭਾ ਆਦਿ ਤੋਂ ਵੀ ਡਿਜ਼ਾਈਨ ਲੈ ਕੇ ਉਹਨਾਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਮੇਰੀ ਇਹ ਡਿਜ਼ਾਈਨ ਬਹੁਤ ਪਸੰਦ ਆਉਂਦੇ ਸਨ ਫਿਰ ਮੈਂ ਇਹਨਾਂ ਦੇ ਨਾਲ ਆਪਣਾ ਇੱਕ ਨਵਾਂ ਯੂਟੀਊਬ ਚੈਨਲ ਵੀ ਬਣਾਇਆ ਜਿਸ 'ਤੇ ਉਹਨਾਂ ਨੂੰ ਆਪਣੇ ਡਿਜ਼ਾਇਨਾਂ ਨੂੰ ਅਪਲੋਡ ਵੀ ਕੀਤਾ ਜਿਹੜੇ ਕਿ ਡਿਜ਼ਾਇਨ ਮੇਰੇ ਬਹੁਤ ਪਸੰਦ ਕੀਤੇ ਗਏ ਇਸ ਦੇ ਨਾਲ ਮੇਰੀ ਆਮਦਨੀ ਦਾ ਵੀ ਸਾਧਨ ਬਣਿਆ ਅਤੇ ਮੇਰੀ ਪਬਲਿਸਿਟੀ ਵੀ ਹੋਈ ਇਸ ਦਾ ਸਿਲਾਈ ਕਢਾਈ ਦਾ ਮੈਨੂੰ ਆਪਣੇ ਹੁਨਰ ਦੇ ਨਿਖਾਰਨ ਵਿੱਚ ਬਹੁਤ ਫਾਇਦਾ ਮਿਲਿਆ ਅਤੇ ਮੈਂ ਆਪਣੇ ਅਧਿਆਪਕਾਂ ਦਾ ਅਤੇ ਆਪਣੇ ਮਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਕਿ ਮੇਰਾ ਹੁਨਰ ਨੂੰ ਨਿਖਾਰ ਕੇ ਸਭ ਦੇ ਸਾਹਮਣੇ ਲੈ ਕੇ ਆਈ